ਹੈਲੋ ਵਧੀਆ ਮਨੀ ਤੂੰ ਦੱਸ ਵਧੀਆ ਬਾਈ ਠੀਕ ਠਾਕ ਕੁਛ ਨਹੀਂ ਵਿਹਲੇ ਹਾਂ ਹੋਰ ਘਰ ਪਰਿਵਾਰ ਠੀਕ ਆ ਸਾਰੇ ਹੋਰ ਕੀ ਕਰਦਾ ਅੱਜ ਕੱਲ੍ਹ ਹਾਂ ਬਾਈ ਮੈਂ ਵੀ ਹੁਣ ਸੋਚਦਾ ਸੀਗਾ ਆਪਾਂ ਡਿਗਰੀ ਕਰ ਲਈ ਹੈ ਜੋਬ ਕਰੀਏ ਕੋਈ ਦੇਖੀਏ ਲੱਭੀਏ ਘਰ ਹੁਣ ਕਿੰਨੇ ਕੁ ਟਾਇਮ ਐਂ ਵਿਹਲੇ ਬੈਠਾਂਗੇ ਹਾਂ ਟੀਚਿੰਗ ਦੀ ਬਈ ਇੰਟਰਸਟ ਹੀ ਹੁਣ ਜਦੋਂ ਤੈਨੂੰ ਪਤਾ ਆਪਣਾ ਟੀਚਿੰਗ 'ਚ ਹੈ ਹੋਰ ਪਾਸੇ ਆਪਾਂ ਹੋਰ ਲੈਣ ਵਾਲੇ ਬਣੇ ਨੀਗੇ ਰਿਜਿਊਮ ਵਗੈਰਾ ਫਿਲ ਕਰਤੇ ਤੂੰ ਅੱਛਾ ਹਾਂ ਮੇਰਾ ਵੀ ਬਣਾ ਦੇਈ ਯਾਰ ਰਿਜਿਊਮ ਹਾਂ ਤੇ ਉਹ ਐਂ ਸੀਗਾ ਨਾ ਲੈਪਟਾਪ ਤੇਰੇ ਕੋਲ ਹੈਗਾ ਗਾ ਪ੍ਰਿੰਟ ਵਗੈਰਾ ਤੂੰ ਕੱਢ ਦੀ ਯਾਰ ਮੈਂ ਤਾਂ ਜੇ ਇੱਥੇ ਕੈਫੇ 'ਤੇ ਜਾਊਗਾ ਭਰਾਵਾ ਉਹ ਤਾਂ ਆਪ ਦੋ ਤਿੰਨ ਸੌ ਰੁੁਪਇਆ ਲੈ ਲੈਂਦਾ ਰਿਜਿਊਮ ਬਣਾਉਣ ਦਾ ਕੱਲ੍ਹ ਨੂੰ ਕੱਲ੍ਹ ਨੂੰ ਤਾਂ ਯਾਰ ਬਈ ਮੈਨੂੰ ਕੰਮ ਹੈ ਕਿਤੇ ਮੈਂ ਕਿਤੇ ਜਾ ਕੇ ਆਉਣਾ ਆਪਾਂ ਪਰਸੋਂ ਚੱਲੀਏ ਹਾਂ ਪਰਸੋਂ ਮੈਂ ਆ ਜੂੰਗਾ ਤੇਰੇ ਕੋਲ ਸਵੇਰੇ ਅੱਠ ਸਾਢੇ ਅੱਠ ਵਜੇ ਅਤੇ ਆਪਾਂ ਠੰਡੇ ਠੰਡੇ ਜਾ ਆਵਾਂਗੇ ਜਿਹੜੇ ਆਪਣੇ ਮਤਲਬ ਕਾਲਜ ਆ ਨੇੜੇ ਨੇੜੇ ਇੰਸਟੀਟਿਊਟ ਹੈਗੇ ਆ ਸਕੂਲ ਹੈਗੇ ਆ ਸਾਰੇ ਕਿਤੇ ਆਪਾਂ ਰਿਜਿਊਮ ਦੇ ਆਵਾਂਗੇ ਹਾਂ ਹਾਂ ਅਤੇ ਆਪਣੇ ਨਾਲ ਦੇ ਹਾਂ ਨਾਲੇ ਤਜਰਬਾ ਬਣ ਜੂ ਕਿਉਂਕਿ ਐਂ ਹੋਏ ਯਾਰ ਹੁਣ ਸਰਕਾਰੀ ਨੌਕਰੀ ਦਾ ਤਾਂ ਹਜੇ ਭਰਾਵਾ ਕੋਈ ਪਤਾ ਨਹੀਂ ਸਰਕਾਰ ਨੇ ਕਦੋਂ ਨੌਕਰੀ ਕੱਢਣੀ ਹੈ ਕਦੋਂ ਨਹੀਂ ਆਹ ਹੁਣ ਚਾਰ ਦਿਨਾਂ ਨੂੰ ਵੋਟਾਂ ਪੈਣ ਵਾਲੀਆਂ ਹੈਗੀਆਂ ਮੁੜ ਕੇ ਚੋਣ ਜਾਬਤਾ ਲੱਗ ਜਾਊਗਾ ਛੇ ਮਹੀਨੇ ਫਿਰ ਚੋਣ ਜਾਬਤਾ ਚੱਲੀ ਜਾਊਗਾ ਅਤੇ ਆਪਣੇ ਜਿਹੜੇ ਨਾਲ ਸੀ ਮਨਿੰਦਰ ਸੀਗਾ ਉਹਦੇ ਨਾਲ ਕੋਈ ਗੱਲਬਾਤ ਹੋਈ ਅੱਛਾ ਹਾਂ ਚੱਲ ਵਧੀਆ ਬਈ ਪੀ ਐੱਚ ਡੀ ਵੀ ਵਧੀਆ ਪੀ ਐੱਚ ਡੀ ਕਰਕੇ ਵੀ ਜੋਬ ਮਿਲ ਜਾਂਦੀ ਹੈਗੀ ਅਤੇ ਕੀ ਕਹਿੰਦੇ ਹੁੰਦੇ ਹੈਗੇ ਆਪਣਾ ਨਾਲ ਦਾ ਕੋਈ ਲੱਗਿਆ ਕਿਸੇ ਕਾਲਜ 'ਚ ਕੋਈ ਕਈ ਵਾਰੀ ਹੁੰਦੀ ਆ ਗੱਲਬਾਤ ਕਈ ਵਾਰੀ ਕਿਸੇ ਕਾਲਜ 'ਚ ਲੱਗਿਆ ਹੁੰਦਾ ਨਾਲ ਦਾ ਹਾਂ ਪਰ ਐਂ ਆ ਕਿ ਜੇ ਕੋਈ ਨਾ ਲੱਗਿਆ ਹੋਵੇ ਨਾ ਫਿਰ ਉਹ ਸਿਫਾਰਿਸ਼ ਹੋ ਜਾਂਦੀ ਹੈ ਕਹਿਲਾ ਥੋੜ੍ਹਾ ਮੋਟਾ ਸਹਾਰਾ ਹੋ ਜਾਂਦਾ ਬਾਕੀ ਰਿਜਿਊਮ ਤਾਂ ਆਪਾਂ ਦੇ ਕੇ ਆਵਾਂਗੇ ਹਾਂਜੀ ਆਉਂਦਾ ਪਰਸੋਂ ਤੇਰੇ ਕੋਲ